ਇੱਕ ਕੁੜੀ ਦੀ ਜ਼ਿੰਦਗੀ 'ਚ ਖਾਣਾ ਪਕਾਉਣ ਲਈ ਉਹਦੀ ਮਾਂ ਦੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਪਰ ਮੈਂ ਆਪਣੇ ਪਰਿਵਾਰਕ ਮੈਂਬਰਾਂ ਵਿੱਚੋਂ ਮੈਂ ਆਪਣੇ ਖਾਣਾ ਬਣਾਉਣ ਦੇ ਸ਼ੌਂਕ ਦੀ ਇਹ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੇ ਪਿਤਾ ਜੀ ਨੂੰ ਦਊਂਗੀ ਮੇਰੇ ਡੈਡੀ ਸਨ ਜਿਹੜੇ ਨੂੰ ਬਹੁਤ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਸੀ ਉਹ ਹਰ ਟਾਈਮ ਜਦੋਂ ਵੀ ਖਾਣਾ ਬਣਾਉਂਦੇ ਸੀ ਉਹ ਹਮੇਸ਼ਾਂ ਮੈਨੂੰ ਕਹਿੰਦੇ ਸੀ ਬੇਟਾ ਮੇਰੇ ਕੋਲ ਖੜੋ ਅਤੇ ਮੈਂ ਤੁਹਾਨੂੰ ਦੱਸਦਾਂ ਕ ਕਿਵੇਂ ਸਬਜ਼ੀ ਨਾਲ ਦਾਲ ਬਣਾਈ ਦੀ ਓਹ ਹਰ ਇੱਕ ਚੀਜ਼ ਨੂੰ ਬਹੁਤ ਵਿਸਥਾਰ ਨਾਲ ਦੱਸਦੇ ਸੀ ਕਿ ਦੇਖੋ ਤੜਕਾ ਐਵੇਂ ਭੁੰਨੀ ਦਾ ਇੰਨੇ ਆਪਾਂ ਟਮਾਟਰ ਪਾਉਣੇ ਆ ਇੰਨੇ ਆਪਾਂ ਪਿਆਜ ਪਾਉਣੇ ਆ ਤੇਰੀ ਚੀਜ਼ ਸਵਾਦ ਬਣੀ ਜੇ ਕਈ ਵਾਰੀ ਚੀਜ਼ ਸਵਾਦ ਨਹੀਂ ਬਣਨੀ ਤਾਂ ਵੀ ਉਹਨਾਂ ਨੇ ਹੱਲਾਸ਼ੇਰੀ ਦੇਣੀ ਕਿ ਨਹੀਂ ਬੇਟਾ ਅਗਲੀ ਵਾਰੀ ਤੇਤੋਂ ਵਧੀਆ ਬਣ ਜੂਗੀ ਸਵਾਦ ਬਣ ਜੂਗੀ ਉਹਨਾਂ ਨੇ ਹਰ ਇੱਕ ਚੀਜ਼ ਜੋ ਉਹਨਾਂ ਨੂੰ ਆਉਂਦੀ ਸੀਗੀ ਜਿਵੇਂ ਆਪਾਂ ਹਲਵਾ ਬਣਾਉਂਦੇ ਹਾਂ ਕੜਾਹ ਬਣਾਉਂਦੇ ਹਾਂ ਹੈ ਨਾ ਖੀਰ ਬਣਾਉਂਦੇ ਹਾਂ ਉਹਨਾਂ ਨੇ ਇੱਕ ਇੱਕ ਚੀਜ਼ ਦੱਸਣੀ ਕਿ ਪਾਣੀ ਗਰਮ ਹੋਣਾ ਚਾਹੀਦਾ ਹੈ ਜਾਂ ਫਿਰ ਆਪਾਂ ਹਲ ਜਦੋਂ ਕੜਾਹ ਬਣਾਉਣਾ ਏ ਪਾਣੀ ਨੂੰ ਪਹਿਲਾਂ ਅਲੱਗ ਉਬਾਲ ਲਓ ਚਿੰਨੀ ਇਸ ਟਾਈਮ ਪਾਉਣੀ ਆ ਆਟਾ ਅਸੀਂ ਹੌਲੀ ਭੁੰਨਣਾ ਤੇਜ਼ ਭੁੰਨਾਂਗੇ ਤਾਂ ਕੜਾਹ ਵਧੀਆ ਨਹੀਂ ਬਣੇਗਾ ਆਪਣਾ ਆਪਾਂ ਨੂੰ ਹੌਲੀ ਹੌਲੀ ਬਣਾਉਣਾ ਚਾਹੀਦਾ ਅਤੇ ਖਾਣਾ ਬਣਾਉਣ ਲਈ ਬੜਾ ਹੀ ਕਾਹਲੀ 'ਚ ਨਹੀਂ ਬਣਾਉਣਾ ਚਾਹੀਦਾ ਬੜਾ ਹੀ ਆਰਾਮ ਨਾਲ ਬਣਾਉਣਾ ਚਾਹੀਦਾ ਹੈ ਤਾਂ ਉਹ ਸਵਾਦ ਬਣਦਾ ਹੈ ਅਤੇ ਹਰ ਇੱਕ ਚੀਜ਼ ਦੀ ਕਿੰਨੀ ਮਾਤਰਾ ਪਾਈ ਜਾਂਦੀ ਹੈ ਕਿਵੇਂ ਪਾਏ ਜਾਂਦੀ ਹੈ ਕੀ ਕੀ ਪਾਉਣਾ ਹੈ ਤਾਂ ਕਿ ਖਾਣਾ ਸਵਾਦ ਬਣੇ ਇਹ ਮੇਰੇ ਡੈਡੀ ਨੇ ਮੈਨੂੰ ਬਚਪਨ ਤੋਂ ਹੀ ਇਸ ਨਾ ਸਿਖਾਇਆ ਇਵਨ ਉਹਨਾਂ ਨੇ ਮੈਨੂੰ ਅਤ ਆਟਾ ਗੁੰਨਣ ਤੋਂ ਲੈ ਕੇ ਹਰ ਇੱਕ ਸਬਜ਼ੀ ਹਰ ਇੱਕ ਰੋਟੀਆਂ ਕਿਵੇਂ ਜੇ ਕਈ ਵਾਰੀ ਰੋਟੀ ਗੋਲ ਵੀ ਨਾ ਬਣਨੀ ਉਹਨਾਂ ਨੇ ਫਿਰ ਹੱਲਾਸ਼ੇਰੀ ਦੇਣੀ ਕਿ ਨਹੀਂ ਬੇਟਾ ਅਗਲੀ ਵਾਰੀ ਬਣਾ ਲੇਂਗੀ ਹੋਰ ਸੋਹਣੀ ਬਣੂ ਹੋਰ ਸੋਹਣੀ ਬਣੂ ਇਸ ਕਰਕੇ ਮੇਰੀ ਖਾਣਾ ਬਣਾਉਣ ਦਾ ਸ਼ੌਂਕ ਮੇਰੇ ਡੈਡੀ ਦੀ ਡੈਡੀ ਦਾ ਆਇਆ ਹੈ ਡੈਡੀ ਵੱਲੋਂ ਆਇਆ ਹੈ ਕਿਉਂਕਿ ਉਹਨਾਂ ਨੂੰ ਖੁਦ ਬਹੁਤ ਸ਼ੌਂਕ ਸੀ